ਜੇਕਰ ਗੱਲ ਕਰੀਏ ਤਾਂ ਪੁਰਾਣੇ ਸਮਾਂ ਦੀਆਂ ਖੇਡਾਂ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਆ ਜਾਂਦੀਆਂ ਹਨ ਜਿਵੇਂ ਕਿ ਬਾਂਦਰ ਕਿੱਲਾ ਚਿੜੀ ਬੱਲਾ ਫੁੱਟਬਾਲ ਕ੍ਰਿਕਟ ਅਤੇ ਹੋਰ ਵੀ ਕਈ ਸਾਰੀਆਂ ਗੇਮਾਂ ਆ ਜਾਂਦੀਆਂ ਹਨ ਅਤੇ ਜੇਕਰ ਨਵੀਆਂ ਗੇਮਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਕੁ ਫੁੱਟਬਾਲ ਅਤੇ ਕ੍ਰਿਕਟ ਤਾਂ ਆ ਹੀ ਜਾਂਦੀਆਂ ਹਨ ਕਿਉਂਕਿ ਇਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਮਸ਼ਹੂਰ ਗੇਮਾਂ ਹਨ ਅਤੇ ਇਹਨਾਂ ਨੂੰ ਖੇਡਣ ਲਈ ਬੱਚੇ ਬਹੁਤ ਹੀ ਖੁਸ਼ ਹੁੰਦੇ ਹਨ ਅਤੇ ਉਕਸਾਈਟ ਵੀ ਹੁੰਦੇ ਹਨ ਅਤੇ ਜੇਕਰ ਗੱਲ ਕਰੀਏ ਤਾਂ ਅੱਜ ਦੀ ਨਵੀਂ ਪੀੜ੍ਹੀ ਫੁੱਟਬਾਲ ਅਤੇ ਕ੍ਰਿਕਟ ਦੇ ਉੱਤੇ ਹੀ ਜ਼ਿਆਦਾ ਧਿਆਨ ਦੇ ਰਹੀ ਹੈ ਅਤੇ ਇਸ ਨੂੰ ਹੀ ਆਪਣਾ ਰਾਸ਼ਟਰੀ ਖੇਡ ਮੰਨ ਰਹੀ ਹੈ ਅਤੇ ਫ਼ੋਨ ਦੇ ਵਿੱਚ ਵੀ ਉਹ ਬਹੁਤ ਸਾਰੀਆਂ ਵੀਡੀਓ ਗੇਮਸ ਖੇਲਦੇ ਹਨ ਤੇ ਅਤੇ ਫ਼ੋਨ ਦੇ ਵਿੱਚ ਸਾਰਾ ਦਿਨ ਨਵੀਆਂ ਨਵੀਆਂ ਕੋਈ ਨਾ ਕੋਈ ਗੇਮਾਂ ਖੇਲੀ ਜਾਂਦੇ ਹੈ ਜਿਸ ਦੇ ਨਾਲ਼ ਬੱਚਿਆਂ ਦੀ ਉਹ ਗੱਲ ਨਹੀਂ ਬਣਦੀ ਜੋ ਕਿ ਕ੍ਰਿਕਟ ਅਤੇ ਫੁੱਟਬਾਲ ਦੇ ਵਿੱਚ ਜਿਵੇਂ ਕਿ ਬੱਚਿਆਂ ਦੀ ਸਿਹਤ ਦੇ ਨਾਲ਼ ਤੰਦਰੁਸਤੀ ਵੱਧਦੀ ਹੈ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਬੱਚਿਆਂ ਦੀ ਸਿਹਤ ਦਾ ਵੀ ਬਹੁਤ ਹੀ ਖਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾਂਦਾ ਹੈ ਇਸ ਤਰ੍ਹਾਂ ਬੱਚੇ ਆਪਣੇ ਆਪ ਨੂੰ ਤੇ ਤੰਦਰੁਸਤ ਸਮਝਦੇ ਹਨ ਅਤੇ ਆਪਣੇ ਆਪ ਨੂੰ ਅੱਗੇ ਜਾਣ ਲਈ ਬਹੁਤ ਸਾਰੇ ਯਤਨ ਕਰਦੇ ਹਨ ਜਿਸ ਨਾਲ਼ ਉਹਨਾਂ ਦਾ ਦੁਨੀਆਂ ਪੱਧਰ 'ਤੇ ਨਾਮ ਵੀ ਬਣਦਾ ਹੈ ਅਤੇ ਮਾਪਿਆਂ ਦਾ ਵੀ ਨਾਮ ਰੋਸ਼ਨ ਹੁੰਦਾ ਹੈ ਅਤੇ ਉਹ ਆਪਣਾ ਵੀ ਨਾਮ ਰੋਸ਼ਨ ਕਰਦੇ ਹਨ ਧੰਨਵਾਦ